ਪੰਜਾਬ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਕਾਨੂੰਨ ਦੇ ਰਾਜ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਭਾਰਤ ਦੇ ਸੰਵਿਧਾਨ ਰਾਹੀਂ ਕੀਤੀ ਜਾਂਦੀ ਹੈ ਜਿਸ ਵਿੱਚ ਹਿਊਮਨ ਰਾਈਟਸ ਜੁਡੀਸ਼ਰੀ ਮਨੁੱਖੀ ਅਧਿਕਾਰ ਕਮਿਸ਼ਨ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਜੇਕਰ ਆਪਾਂ ਵੇਖੀਏ ਤਾਂ ਭਾਰਤ ਦਾ ਸੰਵਿਧਾਨ ਡਾਕਟਰ ਬੀ ਆਰ ਅੰਬੇਡਕਰ ਰਾਹੀਂ ਲਿਖਿਆ ਗਿਆ ਜੋ ਕਿ ਸਾਨੂੰ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਦੀ ਆਜ਼ਾਦੀ ਦਿੰਦਾ ਹੈ ਅਤੇ ਇਵੇਂ ਇੱਕ ਧਰਮ ਨਿਰਪਿਕਸ਼ਤਾ ਦੇ ਵੱਲ ਪੂਰੇ ਸਮਾਜ ਨੂੰ ਲੈ ਕੇ ਜਾਂਦਾ ਹੈ ਪੰਜਾਬ ਦੇ ਵਿੱਚ ਵੇਕ ਵੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਧਰਮ ਨਿਰਪੇਖਸ਼ ਨੇ ਉਹ ਕਿਸੇ ਇੱਕ ਧਰਮ ਦੇ ਵੱਲ ਨਹੀਂ ਦੇਖਦੇ ਅਤੇ ਲੋਕ ਸਾਰਿਆਂ ਨੂੰ ਆਪਣੇ ਇੱਕ ਸਮਾਨ ਸਮਝਦੇ ਜੋ ਕਿ ਇੱਕ ਬਹੁਤ ਵੱਡੀ ਅਤੇ ਬਹੁਤ ਸਾ ਅੱਛੀ ਗੱਲ ਹੈ ਅਤੇ ਇਹ ਹੀ ਪੰਜਾਬ ਦੀ ਸੋਚ ਬਹੁਤ ਅੱਗੇ ਪੰਜਾਬ ਨੂੰ ਵਧਾ ਰਹੀ ਹੈ ਕਿ ਇੱਥੇ ਕਿਸੇ ਨਾਲ ਵੀ ਭੇਦਭਾਵ ਉਹਦਾ ਰੰਗ ਰੂਪ ਉਹਦੀ ਜਾਤ ਪਾਤ ਦੇਖ ਕੇ ਨਹੀਂ ਕੀਤਾ ਜਾਂਦਾ ਪਰ ਇੱਕ ਇਹ ਹੀ ਚੀਜ਼ ਹੈ ਜੋ ਕਿ ਸਾਡੇ ਸੰਵਿਧਾਨ ਵਿੱਚ ਵੀ ਇੱਕ ਕਾਨੂੰਨੀ ਤੌਰ 'ਤੇ ਦੱਸਿਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ ਅਤੇ ਉਹਨਾਂ ਦੇ ਨਾਲ ਅੱਛਾ ਸੰਬੰਧ ਬਣਾ ਕੇ ਰੱਖਣਾ ਹੈ ਇੱਕ ਸਾਡੀ ਕਾਨੂੰਨੀ ਪ੍ਰਕਿਰਿਆ ਵੀ ਬਹੁਤ ਵਧੀਆ ਹੈ ਪੰਜਾਬ ਦੇ ਵਿੱਚ ਉਹਦੀ ਜੁਡੀਸ਼ਰੀ ਉਹਦਾ ਕਾਨੂੰਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ ਜੋ ਕਿ ਉਹਨਾਂ ਦੇ ਲੋਕਾਂ ਦਾ ਪੂਰਾ ਸਾਥ ਦਿੰਦਾ ਹੈ